ਭਾਰਤ ਦਾ ਇਤਿਹਾਸ ਬਹੁਤ ਵਿਸ਼ਾਲ ਹੈ ਭਾਰਤ ਗੁਰੂਆਂ ਪੀਰਾਂ ਦੀ ਧਰਤੀ ਕਿਉਂਕਿ ਇੱਥੇ ਬਹੁਤ ਸਾਰੇ ਗੁਰੂ ਪੈਗੰਬਰ ਪੀਰ ਹੋਏ ਨੇ ਸੁਤੰਤਰਤਾ ਤੋਂ ਪਹਿਲਾਂ ਭਾਰਤ ਦੀ ਹਾਲਤ ਬਹੁਤ ਖਰਾਬ ਸੀ ਇੱਥੇ ਅੰਗਰੇਜ਼ਾਂ ਦਾ ਰਾਜ ਸੀਗਾ ਉਹਨਾਂ ਦੀ ਮਰਜ਼ੀ ਚਲਦੀ ਸੀ ਜਿੱਦਾਂ ਉਹ ਕਹਿੰਦੇ ਸੀ ਉਦਾਂ ਕਰਿਆ ਜਾਂਦਾ ਸੀ ਉਹਨਾਂ ਨੇ ਭਾਰਤੀਆਂ ਨੂੰ ਬੰਦੀ ਬਣਾਇਆ ਹੋਇਆ ਸੀਗਾ ਪਰ ਉਸ ਤੋਂ ਬਾਅਦ ਹੀ ਬਹੁਤ ਸਾਰੇ ਲੋਕ ਇਵੇਂ ਦੇ ਹੋਏ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦੇ ਦਿਲਵਾਈ ਜਿਵੇਂ ਕਿ ਕਰਤਾਰ ਸਿੰਘ ਸਰਾਭਾ ਹੋ ਗਿਆ ਭਗਤ ਸਿੰਘ ਹੋ ਗਿਆ ਤੇ ਮਹਾਤਮਾ ਗਾਂਧੀ ਇਹਨਾਂ ਨੇ ਬਹੁਤ ਕੁਝ ਕੀਤਾ ਭਾਰਤ ਲਈ ਤਾਂ ਕਿ ਸਾਨੂੰ ਆਜ਼ਾਦੀ ਮਿਲ ਸਕੇ ਭਗਤ ਸਿੰਘ ਦੀ ਸ਼ਹੀਦੀ ਹੋਈ ਫਿਰ ਕਰਤਾਰ ਸਿੰਘ ਸਰਾਭਾ ਜੀ ਦੇ ਵੀ ਸ਼ਹੀਦੀ ਹੋਈ ਫਿਰ ਮਹਾਤਮਾ ਗਾਂਧੀ ਜੀ ਨੇ ਬਹੁਤ ਸਾਰੇ ਅੰਦੋਲਨ ਚਲਾਏ ਜਿਨ੍ਹਾਂ ਨਾਲ ਭਾਰਤ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੋਇਆ ਭਾਰਤ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਔਰ ਮਹਾ ਇੰਦਰਾ ਗਾਂਧੀ ਜੀ ਦੀ ਤਾਂ ਉਹਨਾਂ ਨੇ ਵੀ ਬਹੁਤ ਕੁਝ ਕੀਤਾ ਭਾਰਤ ਲਈ ਜਿੱਦਾਂ ਕਿ ਘੁੰਗਟ ਪ੍ਰਥਾ ਸੀਗੀ ਉਹਨਾਂ ਨੇ ਉਹ ਵੀ ਹਟਾਈ ਫਿਰ ਬਹੁਤ ਜ਼ਿਆਦਾ ਇਵੇਂ ਦੇ ਨੇਤਾ ਵੀ ਹੋਏ ਜਿਨ੍ਹਾਂ ਨੇ ਚਾਇਲਡ ਲੇਬਰ ਨੂੰ ਕਰਨ ਤੋਂ ਹਟਾਇਆ ਕਿ ਕਿਉਂਕਿ ਜੋ ਬੱਚਾ ਹੈ ਉਹ ਥੋੜ੍ਹੀ ਨਾ ਮਜ਼ਦੂਰੀ ਕਰੇਗਾ ਅਤੇ ਉਹਨਾਂ ਨੇ ਬਹੁਤ ਕੁਝ ਕੀਤਾ ਭਾਰਤ ਲਈ ਹੁਣ ਭਾਰਤ ਦੀ ਹਾਲਤ ਬਹੁਤ ਠੀਕ ਹੈ ਪਹਿਲਾਂ ਨਾਲੋਂ ਭਾਰਤ ਇੱਕ ਸੁਤੰਤਰ ਦੇਸ਼ ਹੈ ਇੱਥੇ ਬੰਦਾ ਆਪਣੀ ਮਰਜ਼ੀ ਨਾਲ ਸਹੀ ਤਰ੍ਹਾਂ ਰਹਿ ਸਕਦਾ ਆਪਣੀ ਮਰਜ਼ੀ ਨਾਲ ਖਾ ਪੀ ਸਕਦਾ ਕਿਤੇ ਵੀ ਜਾ ਸਕਦਾ ਬੰਦੇ ਦੀ ਆਪਣੀ ਮਰਜ਼ੀ ਹੈ ਅਤੇ ਹੁਣ ਭਾਰਤ ਦੇਸ਼ ਬਹੁਤ ਵਧੀਆ ਹੈ